ਪਿਗਨੋਲੀ ਨਟ ਇੱਕ ਪਾਈਨ ਦੇ ਪੇੜ ਤੋਂ ਆਉਂਦਾ ਹੈ ਹੈ ਅਲੱਗ ਖੇਤਰਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪਿਗਨੋਲੀ ਨਟ ਹੁੰਦੇ ਹਾਂ ਹਨ ਇਹ ਛੋਟੇ ਹੁੰਦੇ ਹਨ ਇੱਕ ਬਹੁਤ ਹੀ ਮਿੱਠੇ ਅਤੇ ਅਲੱਗ ਅਲੱਗ ਤਰ੍ਹਾਂ ਦੇ ਸਵਾਦ ਦੇ ਨਟ ਹੁੰਦੇ ਹਨ ਇਹ ਮਹਿੰਗੇ ਨਟ ਹੁੰਦੇ ਹਨ ਇਹ ਠੰਡ ਦੇ ਵਿੱਚ ਪੇੜਾਂ ਤੋਂ ਡਿੱਗਦੇ ਹਨ ਇਹਨਾਂ ਦਾ ਟਾਈਮ ਅਠਾਰਾਂ ਮਹੀਨੇ ਦਾ ਹੁੰਦਾ ਹੈ ਇਹਨੂੰ ਵਕਤ ਦੇ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ ਇਹ ਬਸੰਤ ਰੀਤੂ 'ਚ ਕਲੀਆਂ ਬਣਦੀਆਂ ਹਨ ਅਸ ਇਹਨੂੰ ਸੁੱਕਣ ਲਈ ਅਤੇ ਖੋਲ੍ਹਣ ਲਈ ਵੀਹ ਦਿਨ ਦਾ ਸਮਾਂ ਲੱਗ ਜਾਂਦਾ ਹੈ ਕਈਆਂ ਦੇ ਛਿਲਕੇ ਮੋਟੇ ਹੁੰਦੇ ਹਨ ਉਹਨਾਂ ਨੂੰ ਖੋਲ੍ਹਣ 'ਚ ਮੁਸ਼ਕਿਲ ਹੁੰਦੀ ਹੈ ਹੇਜਲਨਟ ਤੇਲ ਨੂੰ ਹਿੰਦੀ ਵਿੱਚ ਹੇਜਲਨਟ ਤੇਲ ਕਹਿੰਦੇ ਹਨ ਇਹ ਹੇਜਰਨੱਟ ਤੋਂ ਕੱਢਿਆ ਗਿਆ ਇੱਕ ਤਰਲ ਪਦਾਰਥ ਹੁੰਦਾ ਹੈ ਇਹ ਤਵੱਚਾ ਦੀ ਦੇਖਭਾਲ ਵਾਲਾ ਤਰਲ ਪਦਾਰਥ ਹੁੰਦਾ ਹੈ ਇਹ ਖਾਣਾ ਬਣਾਉਣ ਲਈ ਵਾਲਾਂ ਲਈ ਅਤੇ ਤਵੱਚਾ ਦੀ ਦੇਖਭਾਲ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ ਇਹਦੇ ਫਾਇਦੇ ਹਨ ਨੰਬਰ ਇੱਕ ਤਵੱਚਾ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ ਇਹਦੇ ਨਾਲ ਟਾਈਨਿੰਗ ਨਹੀਂ ਹੁੰਦੀ ਇਹ ਟੈਨਿੰਗ ਤੋਂ ਵੀ ਬਚਾਉਂਦਾ ਹੈ ਬਲੱਡ ਪ੍ਰੈਸ਼ਰ ਨੂੰ ਸਰੀਰ ਵਿੱਚ ਚੰਗੀ ਤਰ੍ਹਾਂ ਘੁੰਮਾਉਂਦਾ ਹੈ ਮੁਹਾਸਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਤਵੱਚਾ ਦੀ ਨਮੀ ਨੂੰ ਬਣਾਏ ਰੱਖਦਾ ਹੈ ਇਹਦੇ ਵਿੱਚ ਵਿਟਾਮਿਨ ਈ ਵਿਟਾਮਿਨ ਏ ਵਿਟਾਮਿਨ ਸੀ ਤਾਂ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ